ਭੰਗੜਾ ਜਿਸ ਨੂੰ ਕਿ ਇਕ ਲੋਕ ਨਾਚ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜਦੋਂ ਕਿ ਭੰਗੜਾ ਇੱਕ ਨਾਚ ਹੀ ਨਹੀਂ ਭੰਗੜਾ ਇੱਕ ਸਾਨੂੰ ਸਾਡੀਆਂ ਮਨ ਦੀਆਂ ਭਾਵਨਾਵਾਂ ਨੂੰ ਦਰਸਾਉਣ ਦਾ ਇੱਕ ਬਹੁਤ ਹੀ ਚੰਗਾ ਸਾਧਨ ਹੈ ਜਦੋਂ ਕਿ ਲੋਕ ਭੰਗੜੇ ਬਾਰੇ ਇੱਕ ਬਹੁਤ ਹੀ ਖਾਸ ਤੌਰ 'ਤੇ ਇਸ ਨੂੰ ਲੋਕ ਨਾਚ ਦੇ ਤੌਰ 'ਤੇ ਜਾਣਦੇ ਹਨ ਇਸ ਨੂੰ ਵਿਆਹ ਸ਼ਾਦੀਆਂ ਵਿੱਚ ਲੋਹੜੀ ਵਿੱਚ ਅਤੇ ਕਿਸੇ ਦੇ ਜਨਮਦਿਨ 'ਤੇ ਜਾਂ ਕਿਸੇ ਵੀ ਹੋਰ ਤਿਓਹਾਰ 'ਤੇ ਪਾਇਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜਾ ਇੱਕ ਬਹੁਤ ਹੀ ਨੀਂਹ ਦਾ ਪੱਥਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜਦੋਂ ਕਿ ਭੰਗੜੇ ਨੂੰ ਬਹੁਤ ਸਾਰੇ ਲੋਕ ਸਿਰਫ ਵੇਖ ਕੇ ਹੀ ਆਨੰਦ ਪ੍ਰਾਪਤ ਕਰਦੇ ਹਨ ਜਦੋਂ ਕਿ ਪੰਜਾਬ ਵਿੱਚ ਇਹ ਕਈ ਤਰ੍ਹਾਂ ਦੇ ਤਿਉਹਾਰ ਜਿਵੇਂ ਕਿ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਜਾਂ ਕਿਸੇ ਵੀ ਤਰ੍ਹਾਂ ਦੇ ਛਿੰਝਾਂ ਵਿੱਚ ਜਾਂ ਕਿਸੇ ਦੇ ਨੇਤਰਾਂ ਦੇ ਮੇਲਿਆਂ ਵਿੱਚ ਇਸ ਨੂੰ ਭੰਗੜੇ ਨੂੰ ਇੱਕ ਬਹੁਤ ਹੀ ਮਨੋਰੰਜਨ ਦੇ ਤੌਰ 'ਤੇ ਪਾਇਆ ਜਾਂਦਾ ਹੈ ਭੰਗੜਾ ਇੱਕ ਪੰਜਾਬ ਦੀ ਪਹਿਚਾਣ ਹੀ ਨਹੀਂ ਇਹ ਪੰਜਾਬ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਧੰਨਵਾਦ